ਅਸੀਂ ਯਾਤਰਾ ਮਾਤਾ ਵੈਸ਼ਨੋ ਦੇਵੀ ਗਏ ਅਤੇ ਵੈਸ਼ਨੋ ਦੇਵੀ ਜਾ ਕੇ ਬਹੁਤ ਵਧੀਆ ਫੀਲ ਹੋਇਆ ਮਾਤਾ ਦੇ ਮੱਥਾ ਟੇਕਿਆ ਸਰੀਰ ਨੂੰ ਥਕਾਵਟ ਵੀ ਨਹੀਂ ਆਈ ਤੁਰਕੇ ਚੜ੍ਹੇ ਆ ਲੋਕ ਖੱਚਰਾਂ ਪਰ ਚੜ੍ਹਦੇ ਆ ਜਾਣੀ ਕਿ ਪੌੜੀਆਂ ਚੜ੍ਹਦੇ ਉੱਪਰ ਬੈਠ ਬੈਠ ਕੇ ਜਾਂਦੇ ਹੈ ਵੀ ਮੈਂ ਫਿਰ ਇੱਦਾਂ ਹੀ ਆਨੰਦ ਆਇਆ ਉੱਪਰ ਜਾ ਕੇ ਫਿਰ ਮਾਤਾ ਦੇ ਮੱਥਾ ਟੇਕਿਆ ਵੈਸ਼ਨੋ ਦੇਵੀ ਉੱਥੇ ਜਾ ਕੇ ਸੇਵਾ ਕਰੀ ਜਾਣੀ ਕਿ ਮੱਥਾ ਟੇਕਿਆ ਸੇਵਾ ਕਰੀ ਬਹੁਤ ਵਧੀਆ ਫੀਲ ਹੋਇਆ ਵੀ ਮਾਤਾ ਦੇ ਗਏ ਆਪਾਂ ਯਾਤਰਾ ਸਫਲ ਹੋਈ ਅਤੇ ਅਸੀਂ ਮੱਥਾ ਟੇਕਿਆ ਐਨ ਚੰਗੀ ਤਰ੍ਹਾਂ ਪੌੜੀਆਂ ਚੜ੍ਹੇ ਪਰ ਇਹ ਥਕਾਵਟ ਨਹੀਂ ਮਹਿਸੂਸ ਹੋਈ ਜਿਵੇਂ ਆਪਾਂ ਮਾੜਾ ਜਿਹਾ ਪਿੰਡ ਖੇਡ ਵੀ ਲਈਏ ਥਕਾਵਟ ਮਾਤਾ ਦੇ ਸੱਚੇ ਮਨ ਨਾਲ ਗਏ ਯਾਤਰਾ ਅਤੇ ਆਪਣਾ ਕੋਈ ਮਹਿਸੂਸ ਨਹੀਂ ਹੋਇਆ ਕੋਈ ਇੱਦਾਂ ਦੀ ਗੱਲਬਾਤ ਨਹੀਂ ਹੋਈ ਐਨ ਵਧੀਆ ਮਾਤਾ ਦੇ ਦਰਸ਼ਨ ਪੂਰੇ ਹੋਏ ਵੈਸ਼ਨੋ ਦੇਵੀ ਦੇ ਅਤੇ ਅਤੇ ਮਾਤਾ ਜੀ ਮਿਹਰ ਕਰ ਵੀ ਅਗਲੀ ਵਾਰ ਫਿਰ ਜਾਵਾਂਗੇ ਅਸੀਂ ਯਾਤਰਾ ਕਰਕੇ ਆਵਾਂਗੇ ਮਾਤਾ ਸਫਲ ਕਰੇ ਆਪਣੀ ਯਾਤਰਾ ਫੇਰ ਸਾਡੇ ਵਾਰ 'ਤੇ